ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਮੈਂ ਜਗਦੀਸ਼ ਕੁਮਾਰੀ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਮੈਂ ਇੱਕ ਕੁੜਤਾ ਮੰਗਵਾਇਆ ਸੀ ਫਲਿੱਪਕਾਰਟ ਤੋਂ ਜਿਹੜਾ ਕਿ ਮੈਂ ਔਰਡਰ ਕੀਤਾ ਸੀ ਉਹ 'ਤੇ ਕਢਾਈ ਸੀ ਉਹਦੇ ਉੱਤੇ ਪੰਜਾਬੀ ਕੁੜਤਾ ਸੀ ਉਹ ਮੈਂ ਤੁਹਾਡੇ ਕੋਲ ਮੰਗਵਾਇਆ ਸੀ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਵਧੀਆ ਉੱਤੇ ਕਢਾਈ ਵੀ ਸੀ ਅਤੇ ਜਿਹੜਾ ਕਿ ਮ ਦਸ ਤਰੀਕ ਨੂੰ ਤੁਸੀਂ ਕਿਹਾ ਸੀ ਕਿ ਤੁਹਾਡੇ ਕੋਲ ਪਹੁੰਚ ਜਾਵੇਗਾ ਉਹ ਤਾਂ ਪਹਿਲਾਂ ਹੀ ਛੇ ਤਰੀਕ ਨੂੰ ਪਹੁੰਚ ਗਿਆ ਮੇਰਾ ਫੰਕਸ਼ਨ ਵੀ ਅਟੈਂਡ ਹੋ ਗਿਆ ਬਹੁਤ ਵਧੀਆ ਲੱਗਾ ਬਹੁਤ ਹੀ ਵਧੀਆ ਲੱਗਾ ਮੇਰੇ ਫਰੈਂਡਸ ਨੇ ਬਹੁਤ ਪਸੰਦ ਕੀਤਾ ਸਾਰਿਆਂ ਨੂੰ ਬਹੁਤ ਪਸੰਦ ਆਇਆ ਮੇਰੇ ਬੱਚਿਆਂ ਨੇ ਬਹੁਤ ਪਸੰਦ ਕੀਤਾ ਕੁੜਤਾ ਬਹੁਤ ਵਧੀਆ ਹੈ ਮੈਂ ਫਿਰ ਦੁਬਾਰਾ ਤੁਹਾਡੇ ਕੋਲ ਉਹੀ ਕੁੜਤਾ ਮੰਗਵਾਉਣਾ ਚਾਹੁੰਦੀ ਹਾਂ ਅਤੇ ਜਿਸ ਤਰ੍ਹਾਂ ਦਾ ਮੈਂ ਫੋਟੋ 'ਚ ਦੇਖਿਆ ਸੀ ਸੇਮ ਉਹੀ ਚੀਜ਼ ਹੈ ਉਹੀ ਚੀਜ਼ ਆਈ ਹੈ ਮੈਨੂੰ ਬਹੁਤ ਵਧੀਆ ਲੱਗਾ ਮੈਨੂੰ ਬਹੁਤ ਪਸੰਦ ਆਇਆ ਇਸ ਕਰਕੇ ਮੈਨੂੰ ਤੁਹਾਡੀ ਚੀਜ਼ ਬਹੁਤ ਚੰਗੀ ਲੱਗੀ ਬਹੁਤ ਵਧੀਆ ਲੱਗੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਫੰਕਸ਼ਨ ਅਟੈਂਡ ਕੀਤਾ ਮੈਨੂੰ ਬਹੁਤ ਸੋਹਣਾ ਲੱਗਾ ਬਹੁਤ ਹੀ ਵਧੀਆ ਲੱਗਾ ਮੈਨੂੰ ਫਿਰ ਦੁਬਾਰਾ ਮੈਂ ਕਰਵਾਵਾਂਗੀ ਤੁਹਾਡੇ ਕੋਲ ਹੋਰ ਬਾਕੀ ਮੇਰੇ ਫਰੈਂਡਸ ਵੀ ਕਹਿੰਦੇ ਪਏ ਆ ਕਿ ਮੇ ਅਸੀਂ ਵੀ ਮੰਗਵਾਉਣਾ ਤੁਹਾਨੂੰ ਦੁਬਾਰਾ ਅਸੀਂ ਕਾਲ ਕਰਾਂਗੇ ਫਿਰ ਤੁਹਾਡੇ ਕੋਲ ਅਸੀਂ ਮੰਗਵਾਵਾਂਗੇ ਠੀਕ ਹੈ